ਮੈਂ ਪੰਜਾਬ ਵਿੱਚ ਰਹਿੰਦਾ ਹਾਂ ਅਤੇ ਸਾਡਾ ਜਿਹੜਾ ਭਾਸ਼ਾ ਹੈ ਉਹ ਖੇਤਰੀ ਭਾਸ਼ਾ ਉਹ ਸਾਡੀ ਪੰਜਾਬੀ ਹੈ ਅਤੇ ਸਾਡੇ ਜਿਹੜੇ ਬੈਂਕ ਹੈ ਇੱਥੇ ਦੇ ਤੇ ਉਹਨਾਂ ਵਿੱਚ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਉਹਨਾਂ ਵਿੱਚ ਜਿਹੜੇ ਫਾਰਮ ਹੈ ਸਾਰੇ ਅੰਗਰੇਜ਼ੀ ਵਿੱਚ ਛਾਪੇ ਹੁੰਦੇ ਹਨ ਅਤੇ ਸਰਕਾਰ ਨੂੰ ਅਤੇ ਬੈਂਕ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਫਾਰਮ ਹਨ ਉਹ ਹਿੰ ਪੰਜਾਬੀ ਵਿੱਚ ਛਾਪਣ ਜਾਣ ਤਾਂ ਕਿ ਇੱਥੇ ਦੇ ਜਿਹੜੇ ਲੋਕ ਰਹਿਣ ਵਾਲੇ ਹਨ ਉਹਨਾਂ ਨੂੰ ਫਾਰਮ ਭਰਨੇ 'ਚ ਪੈਸੇ ਕਢਾਉਣੇ 'ਚ ਜਾਂ ਫਿਰ ਪੈਸੇ ਜਮ੍ਹਾਂ ਕਰਾਉਣੇ 'ਚ ਕੋਈ ਦਿੱਕਤ ਨਾ ਹੋਵੇ ਪੜ੍ਹਨੇ ਵਿੱਚ ਆਸਾਨੀ ਹੋਵੇ ਅਤੇ ਉਹ ਪੜ੍ਹ ਕੇ ਆਰਾਮ ਨਾਲ ਆਪਣਾ ਫਾਰਮ ਭਰ ਸਕੇ ਅਤੇ ਉਹਨੂੰ ਕੋਈ ਦਿੱਕਤ ਨਾ ਹੋਵੇ ਅਤੇ ਜਿਹੜੇ ਪੈਸੇ ਵੀ ਕਢਾਉਣਾ ਹੋਵੇ ਤਾਂ ਉਹ ਆਪਣਾ ਫਾਰਮ ਆਪੇ ਭਰ ਸਕੇ ਜਿਹੜੇ ਘੱਟ ਪੜ੍ਹਿਆ ਲਿਖਿਆ ਹੋਵੇ ਉਹ ਵੀ ਆਪਣਾ ਫਾਰਮ ਭਰ ਸਕਦਾ ਹੈ ਅਤੇ ਅੰਗਰੇਜ਼ੀ ਭਾਸ਼ਾ ਇੱਥੇ ਨਾ ਹੋਵੇ ਕਿਉਂਕਿ ਇੱਥੇ ਜਿਹੜੇ ਅੰਗਰੇਜ਼ੀ ਬਹੁਤ ਘੱਟ ਬੰਦਿਆਂ ਨੂੰ ਆਉਂਦੀ ਹੈ ਜਿਸ ਕਰਕੇ ਇਹ ਭਾਸ਼ਾ ਇੱਥੇ ਨਹੀਂ ਚੱਲਦੀ ਹੈ ਸਾਡੀ ਖੇਤਰੀ ਭਾਸ਼ਾ ਪੰਜਾਬੀ ਹੈ ਅਤੇ ਜਿਹੜੇ ਫਾਰਮ ਹੈ ਸਾਰੇ ਉਹ ਪੰਜਾਬੀ ਵਿੱਚ ਛਾਪੇ ਜਾਣ ਜਿਸ ਕਰਕੇ ਏ ਟੀ ਐੱਮ ਕਾਰਡ ਅਪਲਾਈ ਕਰਨਾ ਵਗੈਰਾ ਵਗੈਰਾ ਕੰਮ ਸਾਰੇ ਆਸਾਨ ਹੋਵੇ